ਹਾਂਜੀ ਬਿਲਕੁਲ ਵੀਡੀਓ ਗੇਮ ਬਾਰੇ ਕਾਫੀ ਮਤਲਬ ਜਾਣਕਾਰੀ ਰੱਖਦਾ ਹਾਂ ਵੀਡੀਓ ਗੇਮ ਮੈਂ ਮਤਲਬ ਕਾਫੀ ਕੋਨਟਰਾ ਲਾ ਲਉ ਮਾਰਿਓ ਲਾ ਲਉ ਹੋਰ ਕਾਫੀ ਤਰ੍ਹਾਂ ਦੀਆਂ ਮਤਲਬ ਗੇਮਾਂ ਖੇਡੀਆਂ ਆਂ ਇਹ ਮਤਲਬ ਗੇਮਾਂ ਤਾਂ ਤੁਹਾਡੇ ਮਨਪ੍ਰਚਾਵੇ ਸਾਧਨ ਹੈ ਬੰਦਾ ਕਿਸੇ ਕਿਸੇ ਨਾ ਕਿਸੇ ਨਾ ਕਿਸੇ ਕੰਮ ਲੱਗਿਆ ਰਹਿੰਦਾ ਆ ਹੈ ਨਾ ਦੂਸਰਾ ਇਹਦੇ ਵਿੱਚ ਕੀ ਹੈ ਬੰਦਾ ਨਸ਼ਿਆਂ ਤੋਂ ਦੂਰ ਰਹਿੰਦਾ ਜਾਂ ਬਾਹਰ ਖੇਡਣ ਨਾਲੋਂ ਬੰਦਾ ਉਹੀ ਗੱਲ ਆ ਬੰਦਾ ਬਾਹਰ ਜਾਊਗਾ ਕਿਸੇ ਗਲਤ ਕੰਮ 'ਚ ਪਾਊਗਾ ਹੈ ਨਾ ਜਾਂ ਕੁਛ ਵੀ ਹੈ ਦੂਸਰਾ ਮਤਲਬ ਇਹ ਮਨਪ੍ਰਚਾਵੇ ਦਾ ਸਾਧਨ ਵੀ ਹੈ ਅਤੇ ਬੰਦਾ ਵੀ ਮਤਲਬ ਗਲਤ ਕੰਮਾਂ ਤੋਂ ਬਚਣ ਦਾ ਵੀ ਸਭ ਤੋਂ ਵੱਡਾ ਅਤੇ ਸੌਖਾ ਸਾਧਨ ਹੈ ਇਹ ਵਾਲਾ ਉਹ ਬੰਦਾ ਇਹਦੇ ਨਾਲ ਨਸ਼ੇ ਪੱਤੇ ਤੋਂ ਬਚਿਆ ਰਹਿੰਦਾ ਪਰ ਆਪਦਾ ਕੰਮ ਮਤਲਬ ਸਿ ਕੋਈ ਨਾ ਕੋਈ ਬੰਦੇ ਨੂੰ ਗੇਮਾਂ ਜ਼ਰੂਰ ਨਹੀਂ ਬੰਦਾ ਗੇਮਾਂ ਮਨਪ੍ਰਚਾਵੇ ਵਾਸਤੇ ਬੰਦੇ ਨੂੰ ਗੇਮਾਂ ਤੋਂ ਕਈ ਕਈ ਨੋਲੇਜ ਵੀ ਮਿਲ ਜਾਂਦੀ ਹੈ ਠੀਕ ਹੈ ਮਤਲਬ ਮੈਂ ਛੋਟੇ ਹੁੰਦੇ ਤੋਂ ਹੁਣ ਤੱਕ ਦੀ ਤਕਰੀਬਨ ਜਦੋਂ ਮੈਨੂੰ ਜਦੋਂ ਵੀ ਮੈਨੂੰ ਕੋਈ ਫ੍ਰੀ ਟਾਈਮ ਮਿਲਦਾ ਤਾਂ ਮਤਲਬ ਗੇਮ ਨੂੰ ਮੈਂ ਪ੍ਰੈਫਰੈਸ ਦਿੰਦਾ ਚਾਹੇ ਦਸ ਮਿੰਟ ਦੇਵਾਂ ਪੰਦਰ੍ਹਾਂ ਮਿੰਟ ਦੇਵਾਂ ਪ੍ਰੈਫਰੈਂਸ ਦਿੰਦਾ ਮੈਂ ਕਿਉਂਕਿ ਉਹਦੇ ਨਾਲ ਮਤਲਬ ਬੰਦੇ ਦਾ ਮਨ ਲੱਗਿਆ ਰਹਿੰਦਾ ਉਹਦੇ ਵਿੱਚ ਕੀ ਹੈ ਮਤਲਬ ਬੰਦਾ ਚਲੋ ਘਰ ਬਹਿ ਕੇ ਬਾਹਰ ਅੰਦਰ ਜਾਣ ਦੀ ਬਜਾਏ ਬੰਦਾ ਘਰ ਬਹਿ ਕੇ ਜਿਹੜੇ ਆ ਉਹ ਗੇਮਾਂ ਖੇਡਦਾ ਰਹਿੰਦਾ ਅਤੇ ਬੰਦੇ ਦਾ ਜਿਹੜਾ ਮਨ ਆ ਉਹ ਲੱਗਿਆ ਰਹਿੰਦਾ ਇਕਾਗਰਤਾ 'ਚ ਰਹਿੰਦਾ ਬੰਦੇ ਦਾ ਮਨ